ਹਾਂਜੀ ਪ੍ਰਧਾਨ ਮੰਤਰੀ ਦੀ ਜਨ ਧਨ ਯੋਜਨਾ ਬਾਰੇ ਮੈਂ ਜਾਣਦਾ ਹਾਂ ਇਹ ਪਿਛਲੇ ਨੌ ਸਾਲ ਤੋਂ ਚੱਲ ਰਹੀ ਹੈ ਜਿਸ ਦੇ ਤਹਿਤ ਪੰਜਾਹ ਕਰੋੜ ਅਕਾਊਂਟ ਇਹਨਾਂ ਦੇ ਤਹਿਤ ਖੋਲ੍ਹੇ ਜਾ ਚੁੱਕੇ ਹਨ ਅਤੇ ਇਹ ਜਿਹੜੇ ਖਾਤੇ ਖੋਲਦੇ ਨੇ ਜੀਰੋ ਬੈਲੈਂਸ ਖਾ ਖਾਤਾ ਹੁੰਦਾ ਹੈ ਅਤੇ ਇਹਦਾ ਕੋਈ ਪਨੈਲਟੀ ਦੇ ਚਾਰਜਿਸ ਨਹੀਂ ਹੁੰਦਾ ਇਸ ਦੇ ਨਾਲ ਏ ਟੀ ਐੱਮ ਵੀ ਮਿਲਦਾ ਹੈ ਅਤੇ ਇਸਦੇ ਵਿੱਚ ਦੋ ਲੱਖ ਦਾ ਦੁਰਘਟਨਾ ਬੀਮਾ ਵੀ ਮਿਲਦਾ ਹੈ